ਜੇਕਰ ਅਸੀਂ ਕਿਸੇ ਚੀਜ਼ ਦਾ ਰੋਜ਼ਾਨਾ ਅਭਿਆਸ ਕਰਦੇ ਹਾਂ ਤਾਂ ਸਾਨੂੰ ਉਸਦੀ ਆਦਤ ਹੋ ਜਾਂਦੀ ਹੈ ਅਤੇ ਅਸੀਂ ਕਦੇ ਵੀ ਇਸ ਤੋਂ ਅੱਕਦੇ ਨਹੀਂ ਸਗੋਂ ਸਾਨੂੰ ਉਸ ਚੀਜ਼ ਦੀ ਤਾਂਘ ਹੁੰਦੀ ਰਹਿੰਦੀ ਹੈ ਅਤੇ ਉਹਦੇ ਲਈ ਸਮਾਂ ਕੱਢਣ ਦੇ ਵਿੱਚ ਵੀ ਕੋਈ ਮੁਸ਼ਕਿਲ ਨਹੀਂ ਆਉਂਦੀ ਮੇਰਾ ਸਭ ਤੋਂ ਮਨਪਸੰਦ ਡਾਂਸ ਗਿੱਧਾ ਹੈ ਹਰ ਕੁੜੀ ਨੂੰ ਗਿੱਧਾ ਪਸੰਦ ਹੁੰਦਾ ਹੈ ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ ਉਮੰਗਾਂ ਵਲਵਲਿਆਂ ਅਤੇ ਉਲਾਸ ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ ਪਿਆਰਾ ਲੋਕ ਨਾਚ ਹੈ ਸਦੀਆਂ ਤੋਂ ਇਸ ਲੋਕ ਲਾ ਨਾਚ ਦੀ ਪੰਜਾਬੀ ਜਨਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ ਅਸਲ ਵਿੱਚ ਗਿੱਧਾ ਤਾੜੀ ਨਾਚ ਹੈ ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੋਤੀਆਂ ਹੋਰ ਮੁਟਿਆਰਾਂ ਤਾੜੀ ਮਾਰਦੀਆਂ ਹਨ ਤਾੜੀ ਦਾ ਵਹਾਓ ਲੋਕ ਗੀਤਾਂ ਦੇ ਮੁੱਖ ਰੂਪਾਂ ਬੋਲੀਆਂ ਅਤੇ ਟੱਪਿਆਂ ਦੇ ਨਾਲ ਨਾਲ ਚੱਲਦਾ ਹੈ ਇਹਨਾਂ ਟੱਪਿਆਂ ਅਤੇ ਬੋਲੀਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ ਮੁਰਦਾਨਿਆ ਰਾਹੀਂ ਪੇਸ਼ ਕੀਤਾ ਜਾਂਦਾ ਹੈ ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ ਜਾਂ ਟੱਪੇ ਤੇ ਬੋਲ ਵਿੱਚ ਰਸ ਅਤੇ ਇੱਕ ਸੂਰਤਾ ਕਾਇਮ ਰੱਖਣ ਲਈ ਬੱਲੇ ਬੱਲੇ ਬਈ ਸ਼ਾਵਾ ਸ਼ਾਵਾ ਆਦਿ ਸ਼ਬਦਾਂ ਨੂੰ ਲਮਕਾਈ ਸੁਰ ਵਿੱਚ ਜੋੜ ਲਿਆ ਜਾਂਦਾ ਹੈ ਗਿੱਧਾ ਆਮ ਤੌਰ 'ਤੇ ਵਿਆਹਾਂ ਸਕੂਲ ਕਾਲਜ ਪ੍ਰੋਗਰਾਮ ਜਾਂ ਫਿਰ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਆਪਣੀ ਮਨਪਸੰਦ ਚੀਜ਼ ਤੋਂ ਬੰਦਾ ਕਦੇ ਵੀ ਅੱਕਦਾ ਨਹੀਂ ਅਤੇ ਇਹੀ ਤਾਂ ਉਸਨੂੰ ਅਭਿਆਸ ਕਰਨ ਵਿੱਚ ਪ੍ਰੇਰਿਤ ਕਰਦੀ ਹੈ